ਦੁੱਧ ਦਾ ਫੈਟ ਵਧਾਉਂਣ ਲਈ ਸਾਨੂੰ ਖਲ੍ਹ ਵਡੇਵੇਂ ਹੀ ਪਾਉਣੇ ਪੈਂਦੇ ਹਨ ਹਫ਼ਤੇ 'ਚ ਦੋ ਵਾਰ ਕਾੜਾ ਬਣਾ ਕੇ ਉਹਨਾਂ ਨੂੰ ਦੇਣਾ ਪੈਂਦਾ ਹੈ ਜਿਸ ਨਾਲ ਦੁੱਧ ਦਾ ਫੈਟ ਵਧ ਸਕਦਾ ਹੈ ਉਸ ਚੀਜ਼ ਤੱਤਾਂ ਦੇ ਪ੍ਰਾਪਤ ਕਰ ਸਕਦੇ ਹਾਂ ਖਲ੍ਹ ਅਤੇ ਵੜੇਵਾਂ ਹੀ ਪੁਰਾਣਾ ਨੁਸਖਾ ਹੈ ਜਿਸ ਨਾਲ ਇਹ ਪਸ਼ੂ ਠੀਕ ਠਾਕ ਰਹਿੰਦੇ ਹਨ ਅਤੇ ਦੁੱਧ ਦਾ ਪੋਸ਼ਟਿਕ ਵੱਧ ਜਾਂਦਾ ਹੈ ਦੁੱਧ ਵਿੱਚ ਫੈਟ ਹੁੰਦਾ ਇਸਦੇ ਨਾਲ ਦੇਸੀ ਨੁਸਖਿਆਂ ਵਿੱਚ ਵੀ ਖਲ੍ਹ ਹੀ ਵੜੇਵੇਂ ਹੈ ਸਾਨੂੰ ਆਪਣੇ ਪਸ਼ੂਆਂ ਨੂੰ ਇੱਕ ਦੋ ਇੱਕ ਦੋ ਵਾਰ ਖਲ੍ਹ ਜਾਂ ਵੜੇਵੇਂ ਦਾ ਘੋਲ ਦੇਣਾ ਚਾਹੀਦਾ ਹੈ ਤਾਂ ਜੋ ਇਸ ਦਾ ਪੌਸ਼ਟਿਕ ਤੁਹਾਰ ਸਹੀ ਮਿਲੇ ਉਹਨਾਂ ਨੂੰ ਸਾਨੂੰ ਹਰੇ ਪੱਠੇ ਵੀ ਟਾਈਮ ਸਿਰ ਦੇਣੇ ਚਾਹੀਦੇ ਹਨ ਤੂੜੀ ਉੱਤੇ ਆਟਾ ਘੋਲ ਕੇ ਵੀ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਾ ਇਹ ਹੀ ਆਪਣਾ ਚਾਰਾ ਹੈ ਇਹਨਾਂ ਨੂੰ ਕਈ ਲੋਕ ਦੁੱਧ ਵਧਾਉਣ ਵਾਸਤੇ ਬਾਹਰ ਦੀਆਂ ਫੀਡਾਂ ਦੇ ਦਿੰਦੇ ਹਨ ਪਰ ਇਹ ਨੁਕਸਾਨਦਾਇਕ ਹੈ ਇਹਦੇ ਨਾਲ ਪਸ਼ੂਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਅਤੇ ਸਾਨੂੰ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਸੀਂ ਵੀ ਇਹਨਾਂ ਦਾ ਹੀ ਦੁੱਧ ਪੀਂਦੇ ਹਾਂ ਜਿਹਦੇ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਸਾਨੂੰ ਇਹੋ ਜਿਹਾ ਮਤਲਬ ਤੁਹਾਰ ਮਿਲਦਾ ਰਹੇਗਾ ਅਸੀਂ ਵੀ ਬਿਮਾਰ ਹੋ ਜਾਵਾਂਗੇ ਇਸ ਲਈ ਸਾਨੂੰ ਪਸ਼ੂਆਂ ਦੀ ਅੱਛੀ ਦੇਖਭਾਲ ਕਰਨੀ ਚਾਹੀਦੀ ਹੈ ਟਾਈਮ ਸਿਰ ਉਹਨਾਂ ਨੂੰ ਚਾਰਾ ਦੇਣਾ ਚਾਹੀਦਾ ਹੈ ਔਰ ਦੁੱਧ ਵੀ ਜੇ ਅਗਰ ਇਹ ਉਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਾਂਗੇ ਤਾਂ ਸਾਨੂੰ ਵੀ ਉਹ ਅੱਛੀ ਤਰ੍ਹਾਂ ਆਪਣਾ ਦੁੱਧ ਦੇਣਗੇ ਅਸੀਂ ਵੀ ਆਪਣਾ ਠੀਕ ਠਾਕ ਰਹਾਂਗੇ ਇਸ ਕਰਕੇ ਇਹਨਾਂ ਦੀ ਇਹਨਾਂ ਨੂੰ ਹਰਾ ਚਾਰਾ ਜਿੰਨਾ ਹਰਾ ਚਾਰਾ ਔਰ ਖਲ੍ਹ ਵੜੇਵੇਂ ਦਓਗੇ ਉਨਾਂ ਹੀ ਇਹਨਾਂ ਦਾ ਪੌਸ਼ਟਿਕ ਆਹਾਰ ਵਾਧਾ ਨ ਪੁਰਾਣੇ ਨੁਸਖੇ ਇਹ ਹੀ ਆ ਜਿੰਨਾਂ ਵੀ ਖਲ੍ਹ ਵੜੇਵੇਂ ਦਾ ਘੋਲ ਦਓ ਉਹਦੇ ਨਾਲ ਹੀ ਇਹਨਾਂ ਦਾ ਪੋਸ਼ਟਿਕ ਤੁਹਾਰ ਵੱਧਦਾ ਆ ਫੀਡਾਂ ਫੀਡ ਬਾਅਦ ਦੀਆਂ ਚੀਜ਼ਾਂ ਜੋ ਦਿੰਦੇ ਲੋਕ ਉਹਨਾਂ ਨਾਲ ਦੁੱਧ ਤਾਂ ਉਹ ਦੇ ਦੇਣਗੀਆ ਪਰ ਉਹਨਾਂ ਦੇ ਅੰਦਰ ਨੁਕਸਾਨ ਜ਼ਰੂਰ ਹੋਏਗਾ ਤਾਂ ਜੋ ਉਹਨਾਂ ਨੂੰ ਠੀਕ ਤੁਹਾਰ ਦਿੱਤਾ ਜਾਵੇ ਠੀਕ ਪੋਸ਼ਟਿਕ ਦਿੱਤਾ ਜਾਵੇ ਜਿਹਦੇ ਨਾਲ ਉਹ ਆਪਣਾ ਤੰਦਰੁਸਤ ਰਹਿਣ ਆਪਣਾ ਬਾਕੀ ਪੁਰਾਣਾ ਨੁਸਖਾ ਇਹ ਹੀ ਹੈ ਕਿ ਮੱਝਾਂ ਗਾਵਾਂ ਨੂੰ ਖਲ੍ਹ ਵੜੇਵੇਂ ਨਾਲ ਹੀ ਜ਼ਿਆਦਾ ਦੁੱਧ ਦਾ ਵੱਧਦਾ ਹੈ